ਹੈਲੋ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਗੁਰਪ੍ਰੀਤ ਬੋਲ ਰਹੀ ਹਾਂ ਜੀ ਮੈਮ ਮੈਂ ਤੁਹਾਡੇ ਨਾਲ ਡਿਸਕਸ਼ਨ ਕਰਨੀ ਸੀ ਬੱਚਿਆਂ ਦੇ ਕਲਾਸ ਪ੍ਰਤੀ ਜਿਹੜੇ ਬੱਚੇ ਕਲਾਸ ਵਿੱਚ ਨਹੀਂ ਪੜ੍ਹ ਰਹੇ ਉਨ੍ਹਾਂ ਦੇ ਮੰਮਾ ਪਾਪਾ ਨਾਲ ਅਸੀਂ ਗੱਲ ਕੀਤੀ ਹੈ ਅਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਬੱਚੇ ਘਰ ਆ ਕੇ ਨਹੀਂ ਪੜ੍ਹ ਰਹੇ ਅਤੇ ਉਹ ਬਹੁਤ ਹੀ ਪ੍ਰੇਸ਼ਾਨ ਕਰ ਰਹੇ ਹੈ ਮੈਮ ਮੈਂ ਤੁਹਾਡੇ ਨਾਲ ਇਸ ਵਿਸ਼ੇ ਦੇ ਬਾਰੇ ਗੱਲ ਕਰਨੀ ਸੀ ਹੁਣ ਕੀ ਕੀਤਾ ਜਾਵੇ ਉਹਨਾਂ ਨੂੰ ਕਿਸ ਸ਼ਰਤਾਂ ਨਾਲ ਸਮਝਾਇਆ ਜਾਵੇ ਠੀਕ ਐ ਮੈਮ ਜੀ ਮੈਮ ਐਕਚੁਅਲ਼ੀ ਨਾ ਮੈਮ ਅਸੀਂ ਉਹਨੂੰ ਬੱਚੇ ਨੂੰ ਬੜੇ ਪਿਆਰ ਨਾਲ ਵੀ ਸਮਝਾਇਆ ਵਾ ਡਾਂਟ ਕੇ ਵੀ ਸਮਝਾਇਆ ਬਟ ਉਹ ਕਰ ਨਹੀਂ ਰਹੇ ਇਸ ਕਰਕੇ ਫਿਰ ਮੈਂ ਅੱਜ ਤੁਹਾਡੇ ਨਾਲ ਡਿਸਕਸ਼ਨ ਕੀਤੀ ਵੀ ਅਸੀਂ ਕਿਸੇ ਤਰੀਕੇ ਇਸ ਪ੍ਰੋਬਲਮ ਦਾ ਹੱਲ ਕੱਢੀਏ ਤਾਂ ਜੋ ਉਹ ਪੜ੍ਹਾਈ ਵਿੱਚ ਆਪਣੀ ਰੁਚੀ ਲਾ ਸਕਣ ਹਾਂਜੀ ਠੀਕ ਹੈ ਠੀਕ ਹੈ ਮੈਮ ਠੀਕ ਹੈ ਮੈਮ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਮੈਂ ਤੁਹਾਡੇ ਨਾਲ ਤਾਂ ਹੀ ਤੁਹਾਡੇ ਨਾਲ ਗੱਲ 'ਤੇ ਵਿਸ਼ੇ 'ਤੇ ਗੱਲ ਕੀਤੀ ਠੀਕ ਹੈ ਮੈਮ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਮੋਟੀਵੇਟ ਕਰਾਂਗੇ ਉਹਨਾਂ ਨੂੰ ਕਲਾਸ ਤੋਂ ਥੋੜ੍ਹਾ ਅਲੱਗ ਕਰਾਂਗੇ ਤਾਂ ਕਿ ਥੋੜ੍ਹਾ ਥੋੜ੍ਹਾ ਕਰਕੇ ਉਹਨੂੰ ਪ੍ਰਸ਼ਨ ਉੱਤਰ ਨੂੰ ਸਮਝ ਸਕਣ ਅਤੇ ਪੜ੍ਹਾਈ ਨੂੰ ਮਨ ਲਾ ਕੇ ਪੜ੍ਹ ਸਕਣ ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ ਹਾਂਜੀ

ਠੀਕ ਹੈ ਮੈਮ ਹਾਂਜੀ ਹਾਂਜੀ ਓਕੇ ਮੈਮ ਸਤਿ ਸ਼੍ਰੀ ਅਕਾਲ ਮੈਮ ਮੈਂ ਇਸ ਓਕੇ